ਅਸੀਂ ਜਾਨਵਰ ਜਿੱਥੋਂ ਵੀ ਵਧੀਆ ਮਿਲਣ ਜਿਵੇਂ ਕਿ ਸਾਡੇ ਘਰ ਵਿੱਚ ਬਕਰੀਆਂ ਵੀ ਪਾਲੀਆਂ ਜਾਂਦੀਆਂ ਹਨ ਜੋ ਕਿ ਕਹਿੰਦੇ ਆ ਕਿ ਤੁੰਗ ਵਾਲੀ ਮੰਡੀ ਤੋਂ ਬਹੁਤ ਹੀ ਵਧੀਆ ਮਿਲਦੀ ਹੈ ਇਸ ਕਰਕੇ ਅਸੀਂ ਉਥੋਂ ਬੱਕਰੀਆਂ ਲੈ ਕੇ ਆਉਦੇ ਆ ਤੇ ਹੋਰ ਸਾਡੇ ਜਨਮੇ ਪਾਲਤੂ ਪਸ਼ੂ ਹੈ ਕੁੱਤਾ ਉਹ ਇੱਕ ਰਿਸ਼ਤੇਦਾਰਾਂ ਤੋਂ ਲੈ ਕੇ ਆਉਂਦਾ ਸੀ ਤੇ ਸਾਡੇ ਘਰ ਵਿੱਚ ਮੱਜਾਂ ਗਾਵਾਂ ਵੀ ਹਨ ਉਹ ਕਿਸੇ ਵੀ ਪਿੰਡ ਤੋਂ ਜਿਵੇਂ ਵਧੀਆ ਦੁੱਧ ਦੇਣ ਵਾਲੀ ਮੱਝ ਜਾਂ ਗਾਂ ਮਿਲਦੀ ਹੈ ਤਾਂ ਉਥੋਂ ਲੈ ਆਉਂਦੇ ਆ ਸਾਡੇ ਘਰ ਵਿੱਚ ਬੱਕਰੀ ਕੁੱਤਾ ਮੱਝ ਅਤੇ ਗਾਂ ਹਨ ਉਹਨਾਂ ਦੀ ਕੀਮਤ ਮੱਝ ਦੀ ਕੀਮਤ ਸੱਠ ਹਜਾਰ ਕੁੱਤੇ ਦੀ ਕੀਮਤ ਦਸ ਹਜਾਰ ਬੱਕਰੀ ਦੀ ਕੀਮਤ ਪੰਜ ਚਾਰ ਹੈ ਅਤੇ ਗਾਂ ਦੀ ਕੀਮਤ ਸੱਤਰ ਹਜਾਰ ਹੈ ਇਹਨਾਂ ਵਿੱਚੋਂ ਕਮਾਈ ਅਸੀਂ ਇਕ ਵਾਰ ਕੁੱਤਾ ਪੰਜ ਹਜਾਰ ਦਾ ਲਿਆ ਕੇ ਦਸ ਹਜਾਰ ਦਾ ਵੇਚਿਆ ਸੀ ਅਤੇ ਗਾਂ ਤੋ ਇੱਕ ਵਾਰ ਅਸੀਂ ਵੀਹ ਹਜਾਰ ਦੀ ਕਮਾਈ ਕੀਤੀ ਸੀ ਬਸ ਹੋਰ ਅਸੀਂ ਕਦੇ ਕੋਈ ਜਾਨਵਰ ਨਹੀਂ ਵੇਚਿਆ